ਮੈਂ ਜਦੋਂ ਖੇਤੀਬਾੜੀ ਸ਼ੁਰੂ ਕੀਤੀ ਸੀ ਉਸ ਤੋਂ ਪਹਿਲਾਂ ਮੈਂ ਪਹਿਲਾਂ ਬੈਂਕ ਦੇ ਵਿੱਚ ਜਾ ਕੇ ਦੇਖਿਆ ਕਿ ਅਲੱਗ ਅਲੱਗ ਐਸ ਬੀ ਆਈ ਬੈਂਕ ਹੈ ਜਾਂ ਐਚ ਡੀ ਐਫ ਸੀ ਬੈਂਕ ਹੈ ਪੀ ਐਨ ਬੀ ਬੈਂਕ ਹੈ ਕਾਫੀ ਸਾਰੇ ਪ੍ਰਾਈਵੇਟ ਬੈਂਕ ਵੀ ਹੈਗੇ ਐ ਜਿਹਨਾਂ 'ਚ ਅਲੱਗ ਅਲੱਗ ਲੋਨ ਦੀਆਂ ਵਿਧੀਆਂ ਮੌਜੂਦ ਹਨ ਅਤੇ ਉਹ ਮੈਂ ਸਾਰੀਆਂ ਪਤਾ ਕੀਤੀਆਂ ਵੀ ਕਿਹੜੇ ਕਿਹੜੇ ਬੈਂਕ ਕਿੰਨਾ ਲੋਨ ਦਿੰਦਾ ਉਹਦੇ 'ਤੇ ਕਿੰਨਾ ਇੰਟਰਸਟ ਆਉਂਦਾ ਹੈਗਾ ਫਿਰ ਉਸ ਹਿਸਾਬ ਨਾਲ ਮੈਂ ਆਪਣਾ ਲੋਨ ਲੈ ਲਿਆ ਹੈ ਜਿਵੇਂ ਟਰੈਕਟਰ ਦਾ ਲੋਨ ਕਰਾ ਲਿਆ ਟਰੈਕਟਰ 'ਤੇ ਮਤਲਬ ਪੰਜ ਪਰਸੈਂਟ ਇੰਟਰਸਟ ਦੇ ਉੱਤੇ ਐੱਸ ਬੀ ਆਈ ਬੈਂਕ ਲੋਨ ਦੇ ਰਿਹਾ ਸੀਗਾ ਤਾਂ ਉਹ ਵੀ ਲੋਨ ਅਵੇਲੇਬਲ ਹੈਗਾ ਹੈਗਾ ਬੈਂਕ ਦੇ ਵਿੱਚ ਸਰਕਾਰੀ ਬੈਂਕ ਹੈਗਾ ਐਸ ਬੀ ਆਈ ਅਤੇ ਇਹਦੇ 'ਤੇ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਵੀ ਮਿਲਦੀਆਂ ਹਨ ਜਿਹਦੇ ਕਰਕੇ ਕਿ ਮੈਂ ਆਪਣੀ ਖੇਤੀਬਾੜੀ ਨੂੰ ਵਧੀਆ ਤਰੀਕੇ ਨਾਲ ਚਲਾ ਸਕਦਾ ਹਾਂ ਅਤੇ ਹੋਰ ਵੀ ਕਾਫੀ ਬੈਂਕ ਹਨ ਕਿ ਜਿਹੜੇ ਲੋਨ ਦਿੰਦੇ ਹਨ ਪਰ ਮੈਂ ਇਹ ਦੇਖਦਾ ਕਿ ਸਭ ਤੋਂ ਘੱਟ ਜਿਹੜਾ ਇੰਟਰਸਟ ਕਿ ਸਭ ਤੋਂ ਵਧੀਆ ਬੈਂਕ ਕਿਹੜਾ ਹੈਗਾ ਉਹਦੇ ਹਿਸਾਬ ਨਾਲ ਮੈਂ ਆਪਣਾ ਲੋਨ ਲੈ ਲੈਂਦਾ ਜੀ